ਕੀ ਮੇਰੀ ਗੱਲ ਸੰਤ ਮੋਟਰਸ 'ਚ ਹੋ ਰਹੀ ਆ ਮੈਂ ਸੁਮਨਪ੍ਰੀਤ ਗੱਲ ਕਰ ਰਹੀ ਹਾਂ ਅਤੇ ਮੈਂ ਔਲ ਔਲਵੇਜ ਤੁਹਾਡੀਆਂ ਜਿਹੜੀਆਂ ਕੈਬਸ ਨੇ ਉਹ ਬੁੱਕ ਕਰਦੀ ਰਹਿੰਦੀ ਹਾਂ ਅਤੇ ਐਕਚਲੀ ਅਰਜੈਂਟ ਨੀਡ ਆ ਮੈਨੂੰ ਤੁਹਾਡੀ ਕੈਬ ਦੀ ਬਹੁਤ ਜ਼ਿਆਦਾ ਮੇਰੀ ਮਦਰ ਨੇ ਅੰਮ੍ਰਿਤਸਰ ਤੋਂ ਮੋਹਾਲੀ ਸ਼ਿਫਟ ਕਰਨਾ ਆ ਉੱਥੇ ਉਹ ਇਕੱਲੇ ਨੇ ਅਤੇ ਇੱਥੇ ਮੈਂ ਇਕੱਲੀ ਹਾਂ ਅਤੇ ਇਹ ਚੀਜ਼ ਕਰਕੇ ਮੈਂ ਤੁਹਾਡੀ ਇੱਥੋਂ ਇੱਕ ਕੈਬ ਬੁੱਕ ਕਰਨਾ ਚਾਹੁੰਦੀ ਹਾਂ ਜੋ ਕਿ ਮੇਰੀ ਮੰਮਾ ਨੂੰ ਉੱਥੋਂ ਲਿਆ ਕੇ ਮੇਰੇ ਤੱਕ ਇੱਥੇ ਤੱਕ ਡਰੋਪ ਕਰ ਸਕੇ ਪਿੱਕ ਐਂਡ ਡਰੋਪ ਕਰ ਸਕੇ ਅਤੇ ਤੁਹਾਡੀ ਇੱਕ ਇੱਥੇ ਕੈਬ ਵਾਲਿਆਂ 'ਚ ਦਲਜੀਤ ਸਰ ਹਨ ਜਿਹੜੇ ਸਾਡੇ ਨੋਨ ਟੂ ਹਨ ਅਤੇ ਸਾਨੂੰ ਬਹੁਤ ਹੀ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਮੇਰੀ ਮਦਰ ਦਾ ਰੁਝਾਉ ਹੈ ਕਿ ਜੇ ਉਹ ਉਹਨਾਂ ਨੂੰ ਲੈਣ ਚਲ ਜਾਣ ਤਾਂ ਜ਼ਿਆਦਾ ਬੈਸਟ ਹੈ ਕਿਉਂਕਿ ਮੇਰੀ ਮਦਰ ਥੋੜ੍ਹੇ ਡਿਸੀਜਿਜ ਹਨ ਉਹ ਬਿਮਾਰ ਰਹਿੰਦੇ ਆ ਜ਼ਿਆਦਾਤਰ ਅਤੇ ਉਹਨਾਂ ਦਾ ਜਿਹੜਾ ਆਉਣ ਦਾ ਆ ਨਾ ਉਹ ਥੋੜ੍ਹਾ ਰੁਕ ਰੁਕ ਕੇ ਆਉਣਗੇ ਰਸਤੇ 'ਚ ਤਾਂ ਕਿ ਜਿਹੜੇ ਡਰਾਈਵਰ ਨੂੰ ਉਹਨੂੰ ਵੀ ਪ੍ਰੋਬਲਮ ਨਾ ਹੋਵੇ ਕੋਈ ਹੋਰ ਜਾਵੇ ਕਿਉਂਕਿ ਦਲਜੀਤ ਸਰ ਤਾਂ ਸਾਨੂੰ ਔਲਰੇਡੀ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕੀ ਪ੍ਰੋਬਲਮ ਆ ਤਾਂ ਕਿ ਉਹ ਵੀ ਪ੍ਰੇਸ਼ਾਨ ਨਾ ਹੋਣ ਅਤੇ ਮੇਰੀ ਮਦਰ ਵੀ ਪ੍ਰੇਸ਼ਾਨ ਨਾ ਹੋਵੇ ਅਤੇ ਮੇਰੀ ਇਹੀ ਸਹਾਇਤਾ ਆ ਤੁਹਾਡੇ ਅੱਗੇ ਰਿਕੁਐਸਟ ਆ ਵੀ ਪਲੀਜ਼ ਮੇਰੀ ਮਦਰ ਨੂੰ ਲੈ ਕੇ ਆਉਣ 'ਚ ਮੇਰੀ ਥੋੜ੍ਹੀ ਹੈਲਪ ਕਰੀ ਜਾਵੇ ਅਰਾਮ ਨਾਲ ਅਤੇ ਜਿਹੜੀ ਪੇਮੈਂਟ ਆ ਉਹ ਮੈਂ ਤੁਹਾਨੂੰ ਇੱਥੋਂ ਹੀ ਦੇਵਾਂਗੀ ਤੁਸੀਂ ਮੈਨੂੰ ਆਪਣਾ ਬਾਰਕੋਡ ਭੇਜ ਸਕਦੇ ਹੋ ਅਤੇ ਮੈਂ ਤੁਹਾਨੂੰ ਨਾਲ ਦੀ ਨਾਲ ਪੇਮੈਂਟ ਕਰ ਦੇਵਾਂਗੀ ਅਤੇ ਧੰਨਵਾਦ ਤੁਹਾਡਾ